ਯਕੀਨਨ ਬ੍ਰਹਿਮੰਡ ਇੱਕ ਮਨ ਨੂੰ ਹੈਰਾਨ ਕਰਨ ਵਾਲੀ ਜਗ੍ਹਾ ਹੈ ਜੋ ਹੈਰਾਨੀਜਨਕ ਖੋਜਾਂ ਅਤੇ ਮਨ ਨੂੰ ਝੁਕਾਉਣ ਵਾਲੇ ਵਰਤਾਰੇ ਨਾਲ ਭਰੀ ਹੋਈ ਹੈ ਇਸ ਬਾਰੇ ਜੋ ਮੈਨੂੰ ਕੁਛ ਜਿਹੜੀਆਂ ਗੱਲਾਂ ਹੈਗੀਆਂ ਵੀ ਜਿਹੜੀ ਮੈਨੂੰ ਦਿਲਚਸਪ ਲੱਗਦੀਆਂ ਹਨ ਪਹਿਲੀ ਤਾਂ ਬਈ ਉਹ ਜਿਹੜੇ ਬਈ ਆਪਣੇ ਮਿਲਕੀਵੇ ਅਕਾਸ਼ ਗੰਗਾ ਕਹਿੰਦੇ ਨੇ ਉਹਨੂੰ ਅਤੇ ਸਾਡਾ ਬ੍ਰਹਿਮੰਡ ਅਤੇ ਅਕਾਸ਼ ਗੰਗਾ ਦੀ ਦੂਰੀ ਲਗਪਗ ਇੱਕ ਲੱਖ ਪ੍ਰਕਾਸ਼ ਸਾਲ ਵਿੱਚ ਫੈਲਿਆ ਹੋਇਆ ਹੈ ਅਤੇ ਇਸਨੂੰ ਪਾਰ ਕਰਨ ਲਈ ਆਪਾਂ ਨੂੰ ਇੱਕ ਲੱਖ ਸਾਲ ਲਈ ਪ੍ਰਕਾਸ਼ ਦੀ ਗਤੀ ਨਾਲ ਯਾਤਰਾ ਕਰਨੀ ਪੈਣੀ ਹੈ ਤੁਸੀਂ ਕਪਲਨਾ ਕਰੋ ਬਾਈ ਕਿੰਨੀ ਦੂਰ ਪੈ ਗਿਆ ਇਹ ਅਤੇ ਦੂਜਾ ਬ੍ਰਹਿਮੰਡ ਲਗਭਗ ਤੇਰਾਂ ਪੁਆਇੰਟ ਸੱਤ ਅਰਬ ਸਾਲ ਪੁਰਾਣਾ ਹੋਣ ਦਾ ਅਨੁਮਾਨ ਹੈਗਾ ਅਤੇ ਮੰਨ ਕੇ ਚਲੋ ਬਿਗ ਬੈਂਗ ਤੋਂ ਬਾਅਦ ਲੰਘੇ ਵਿਸ਼ਾਲ ਸਮੇਂ ਬਾਰੇ ਸੋਚਣਾ ਕਮਾਲ ਦੀ ਗੱਲ ਹੈ ਬਈ ਇਹਦੇ ਬਾਰੇ ਬਾਹਲੇ ਸਾਰੇ ਦਿਲਚਸਪ ਰਹੱਸ ਹੈ ਜਿਵੇਂ ਆਪਣਾ ਬਈ ਨਵੇਂ ਤਾਰੇ ਕਿਵੇਂ ਬਣਦੇ ਆਂ ਕਿਵੇਂ ਗਲੈਕਸੀਆਂ ਰੀਸਾਈਕਲ ਹੁੰਦੀਆਂ ਬਈ ਆਪਣੇ ਨਵੇਂ ਤਾਰੇ ਬਣਾਉਣ ਲਈ ਅਤੇ ਬ੍ਰਹਿਮੰਡ ਵਿੱਚ ਹਨੇਰੀ ਊਰਜਾ ਹੁੰਦੀ ਹੈ ਜਿਵੇਂ ਤਾਂ ਕਿਵੇਂ ਕਿਵੇਂ ਕੰਮ ਚੱਲਦਾ ਹੋਊਗਾ ਬਈ ਕਿਵੇਂ ਟਿਕਿਆ ਹੋਇਆ ਹੈ ਕਿਵੇਂ ਧਰਤੀ ਘੁੰਮਦੀ ਹੁੰਦੀ ਹੈ ਇਹ ਸਾਰੀਆਂ ਜੋ ਹੈਗੀਆਂ ਦਿਲਚਸਪ ਗੱਲਾਂ ਹੈ ਬੜੀਆਂ ਆਪਣੇ ਬ੍ਰਹਿਮੰਡ਼ ਬਾਰੇ